ਹਾਂਜੀ

ਸਰ ਅਸੀਂ ਨਾ ਫਰੂਟ ਲੈਣਾ ਸੀ ਕੇਲੇ ਸੇਬ ਅੰਗੂਰ ਵਗੈਰਾ ਹਾਂਜੀ ਰੇਟ ਕਿੰਨੇ ਕਿੰਨੇ ਦਾ ਹਾਂਜੀ ਅੱਛਾ ਸਰ ਬਹੁਤ ਉਹ ਲਾਏ ਦੇ ਤੁਸੀਂ ਰੇਟ ਬਾਹਲ਼ਾ ਘੱਟ ਕਰੋ ਨਾ ਥੋੜ੍ਹਾ ਜਿਹਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਅਤੇ ਚਲੋ ਠੀਕ ਹੈ ਕਰਦੋ ਫਿਰ ਪੈਕ ਠੀਕ ਹੈ ਓਕੇ